ਹੈਲੋ ਮੈਂ ਮਿੰਤਰਾ ਦੀ ਇੱਕ ਕਸਟਮਰ ਬੋਲ ਰਹੀ ਹਾਂ ਮੈਨੂੰ ਥੋੜ੍ਹੇ ਦਿਨ ਪਹਿਲਾਂ ਕੋਈ ਫੇਸ 'ਤੇ ਪ੍ਰੋਬਲਮ ਆਈ ਸੀ ਰੈਸ਼ਸ ਬਹੁਤ ਹੋ ਗਈਆਂ ਸੀ ਟੈਨਿੰਗ ਬਹੁਤ ਹੋ ਗਈ ਸੀ ਜਿਸ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਹੜੀ ਕਰੀਮ ਮੰਗਵਾਵਾਂ ਤਾਂ ਤੁਹਾਡੇ ਜੋ ਸੇਲ ਲੱਗੀ ਸੀ ਪ੍ਰੋਡਕਟਸ ਦੀ ਮੈਂ ਉਸ ਨਾ ਦੇ ਵਿੱਚੋਂ ਇੱਕ ਕਰੀਮ ਫੇਸ ਕਰੀਮ ਮੰਗਵਾਈ ਜਿਸ ਦੇ ਰਵਿਊਜ ਬਹੁਤ ਅੱਛੇ ਦਿੱਤੇ ਗਏ ਸਨ ਉਸ ਕਰੀਮ ਦੀ ਸਰਵਿਸ ਦੇ ਵਿੱਚ ਉਸਦੀ ਚਾਰਜਸ ਬੇਸ਼ਕ ਪਹਿਲਾਂ ਬਹੁਤ ਜ਼ਿਆਦਾ ਸੀ ਪਰ ਜਦੋਂ ਤੁਸੀਂ ਹੋਲੀ ਸਕੀਮ ਦੇ ਤਹਿਤ ਉਸ ਦੀ ਸੇਲ ਲਗਾਈ ਸੀ ਮੈਂ ਉਸ ਸਮੇਂ ਮੰਗਵਾਇਆ ਤਾਂ ਉਸ ਕਰੀਮ ਦੇ ਰਿਜਲਟਸ ਬਹੁਤ ਅੱਛੇ ਆਏ ਇੱਕ ਤਾਂ ਤੁਹਾਡੀਆਂ ਸਰਵਿਸਿਸ ਬਹੁਤ ਅੱਛੀਆਂ ਹਨ ਜੋ ਮੈਨੂੰ ਬਹੁਤ ਪਸੰਦ ਆਈਆਂ ਦੂਸਰਾ ਉਸ ਕਰੀਮ ਦੀ ਐਕਸਪਾਇਰੀ ਡੇਟ ਵਿੱਚ ਵੀ ਬਹੁਤ ਟਾਈਮ ਅਜੇ ਸੀ ਜਿਸ ਕਰਕੇ ਮੈਨੂੰ ਇਹ ਲੱਗ ਰਿਹਾ ਸੀ ਕਿ ਸੇਲ ਵਿੱਚ ਭੇਜੀਆਂ ਜਾਣ ਵਾਲੀਆਂ ਆਈਟਮਾਂ ਦੀ ਐਕਸਪਾਇਰੀ ਡੇਟ ਨਜ਼ਦੀਕ ਹੁੰਦੀ ਹੈ ਉਹ ਵੀ ਚੀਜ਼ ਮੇਰੀ ਸ਼ੱਕ ਦੂਰ ਹੋਇਆ ਦੂਸਰਾ ਤੁਹਾਡੇ ਪ੍ਰੋਡਕਟਸ ਦੇ ਜਿਸ ਤਰ੍ਹਾਂ ਦੇ ਰੀਵਿਊ ਸਨ ਉਹ ਪ੍ਰੋਡਕਟ ਉੱਦਾਂ ਦਾ ਹੀ ਨਿਕਲਿਆ ਉਸਨੇ ਬੜੀ ਜਲਦੀ ਹੀ ਮੇਰੀ ਟੈਨਿੰਗ ਦੀ ਅਤੇ ਮੇਰੀ ਰੈਸ਼ਸ ਦੀ ਪ੍ਰੋਬਲਮ ਨੂੰ ਸੋਲਵ ਕੀਤਾ ਪ੍ਰੋਡਕਟ ਸੱਚਮੁੱਚ ਕਾਬਿਲ ਏ ਤਾਰੀਫ਼ ਸੀ ਪ੍ਰੋਡਕਟ ਦੇ ਨਾਲ ਉਸਦਾ ਜੋ ਪ੍ਰਾਈਸ ਸੀ ਉਹ ਮੈਨੂੰ ਬਹੁਤ ਅੱਛਾ ਰਿਹਾ ਕਿਉਂਕਿ ਉਹ ਪ੍ਰੋਡਕਟ ਸੇਲ ਤੋਂ ਬਿਨ੍ਹਾਂ ਬਹੁਤ ਮਹਿੰਗਾ ਸੀ ਅਤੇ ਤੁਹਾਡੇ ਵਲੋਂ ਦਿੱਤੇ ਗਈ ਥ ਸੈਂਤੀ ਪਰਸੈਂਟ ਓਫ 'ਤੇ ਮੈਨੂੰ ਉਹ ਪ੍ਰੋਡਕਟ ਬੜੀ ਜਲਦੀ ਹੀ ਮਿਲ ਗਿਆ ਤੁਹਾਡੀਆਂ ਸੇਵਾਵਾਂ ਲਈ ਬਹੁਤ ਸ਼ੁਕਰੀਆ ਮੈਂ ਤੁਹਾਡੀ ਹਮੇਸ਼ਾਂ ਰੈਗੂਲਰ ਕਸਟਮਰ ਰਹਾਂਗੀ ਜੀ